ਪੰਜਾਬ ਸਰਕਾਰ ਜੀ ਕਾਫ਼ੀ ਮਿਹਨਤ ਕਰ ਰਹੀ ਹੈ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਖੇਡਾਂ ਦੇ ਵਿੱਚ ਹੁਣ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਨਵੇਂ ਨਵੇਂ ਢੰਗਾਂ ਦੇ ਨਾਲ ਲੋਕ ਜਿਹੜੇ ਹਨ ਉਹ ਖੇਡਾਂ ਵਿੱਚ ਰੁਚੀ ਲ ਲੈ ਰਹੇ ਨੇ ਪਹਿਲਾਂ ਸਮਾਂ ਸੀ ਕਿ ਲੋਕ ਖੇਡਾਂ ਜਿਹੜੀਆਂ ਨੇ ਚੱਲ ਕੇ ਜਾਂਦੇ ਸੀ ਦੇਖਣ ਦੇ ਲਈ ਪਰ ਹੁਣ ਉਹ ਸਮਾਂ ਨਹੀਂ ਹੈ ਹੁਣ ਘਰ ਬੈਠੇ ਮੋਬਾਈਲ ਰਾਹੀਂ ਜਾਂ ਟੀ ਵੀ ਦੇ ਮਾਧਿਅਮ ਰਾਹੀਂ ਵੀ ਲੋਕ ਖੇਡਾਂ ਦਾ ਅਨੰਦ ਲੈ ਸਕਦੇ ਹਨ ਅਤੇ ਹੁਣ ਜਿਹੜਾ ਹੈ ਘਰ ਘਰ ਦੇ ਵਿੱਚ ਲੋਕਾਂ ਨੂੰ ਖੇਡਾਂ ਬਾਰੇ ਪਤਾ ਲੱਗਦਾ ਹੈ ਅਤੇ ਬੱਚਿਆਂ ਦਿਆਂ ਵਿੱਚ ਬਹੁਤ ਸ਼ੌਂਕ ਜਿਹੜਾ ਇਹਦਾ ਵਧਿਆ ਹੈ ਪਹਿਲਾਂ ਦੇ ਮੁਕਾਬਲੇ ਵਿੱਚ ਕਿਉਂਕਿ ਪਹਿਲਾਂ ਇੱਕ ਜੇ ਕਿਸੇ ਇੱਕ ਪਿੰਡ ਦੇ ਵਿੱਚ ਹੈ ਖੇਡਾਂ ਦਾ ਕੋਈ ਪ੍ਰੋਗਰਾਮ ਤਾਂ ਲੋਕ ਚੱਲ ਕੇ ਜਾਂਦੇ ਸੀ ਕਈਆਂ ਕੋਲ ਸਮਾਂ ਨਹੀਂ ਹੁੰਦੀ ਸੀ ਜਾਣ ਦਾ ਪਰ ਹੁਣ ਜੇ ਬੰਦਾ ਨਹੀਂ ਵੀ ਜਾ ਜਾ ਸਕਦਾ ਤਾਂ ਉਹ ਆਪਣਾ ਕੰਮ ਕਰਦੇ ਕਰਦੇ ਟੀ ਵੀ ਦੇ ਉੱਪਰ ਖੇਡਾਂ ਦਾ ਆਨੰਦ ਲੈ ਸਕਦਾ ਹੈ